ਹਾਂਜੀ ਸਾਡੇ ਰਾਜ ਦੇ ਵਿੱਚ ਜਿਹੜੇ ਆ ਜਿਵੇਂ ਹੈਗੇ ਮੁੱਖ ਸਥਾਨ ਜਿਵੇਂ ਹੋ ਗਿਆ ਰਾਮ ਤੀਰਥ ਹੋ ਗਿਆ ਮਾਡਲ ਟਾਊਨ ਹੋ ਗਿਆ ਸ਼ੀਤਲਾ ਮੰਦਰ ਹੋ ਗਿਆ ਦੁਰਗਿਆਣਾ ਮੰਦਰ ਹੋ ਦੁਰਗਿਆਣਾ ਮੰਦਰ ਗੋਲਡਨ ਟੈਂਪਲ ਹੋ ਗਿਆ ਗੋਲਡਨ ਟੈਂਪਲ 'ਚ ਮਤਲਬ ਕਾਫੀ ਯਾਤਰੀ ਬੜੇ ਦੂਰੋਂ ਦੂਰ ਹੁੰਦੇ ਨੇ ਮੱਥਾ ਟੇਕਦੇ ਨੇ ਇਸ ਤਰ੍ਹਾਂ ਹੀ ਉਹ ਮਤਲਬ ਸ਼ੀਤਲਾ ਮੰਦਰ ਵੀ ਜਾਂਦੇ ਨੇ ਦੁਰਗਿਆ ਮਾਡਲ ਟਾਊਨ ਵੀ ਜਾਂਦੇ ਨੇ ਹਾਂ ਮੇਰਾ ਮੇਰੇ ਲਾਗੇ ਮਾਡਲ ਟਾਊਨ ਪੈਂਦਾ ਏ ਅਤੇ ਮੈਂ ਤਕਰੀਬਨ ਰੋਜ਼ ਜਾਂਦੀ ਹਾਂ ਉੱਥੇ ਅਸੀਂ ਬੈਠ ਕੇ ਸਾਰੇ ਸਤਸੰਗ ਕਰਦੇ ਨੇ ਜਿਸ ਨਾਲ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਹੁਣ ਹਲਾਂ ਹੀ ਸਾਡੇ ਇੱਥੇ ਪੂਰਾ ਰਾਮ ਜੀ ਦਾ ਬਹੁਤ ਵ ਵੱਡਾ ਉਤਸਵ ਮਨਾਇਆ ਗਿਆ ਹੈ ਉਸ ਦਿਨ ਸਾਰੇ ਜਣੇ ਬੈਠ ਕੇ ਅਸੀਂ ਬਹੁਤ ਵਧੀਆ ਕੀਰਤਨ ਕੀਤਾ ਸਾਰੇ ਦਿਨ ਬਹੁਤ ਵਧੀਆ ਸਾਡਾ ਲੰਘਿਆ ਫਿਰ ਸਾਡੇ ਉੱਥੇ ਲੰਗਰ ਵੀ ਚੱਲਿਆ ਸਾ ਸਭ ਨੂੰ ਲੰਗਰ ਵੀ ਖਵਾਇਆ ਅਤੇ ਅਸੀਂ ਬਣਾਇਆ ਵੀ ਨਾਲ ਅਤੇ ਬਹੁਤ ਦਿਨ ਤੱਕ ਅਸੀਂ ਜਿਵੇਂ ਢੋਲ ਢਾਲ ਵੱਜਦੇ ਰਹੇ ਆ ਘਰ ਘਰ ਜਾਂਦੇ ਰਹੇ ਨੇ ਇਹਦੇ ਨਾਲ ਜਿਵੇਂ ਮਨ ਨੂੰ ਬੜੀ ਸ਼ਾਂਤੀ ਮਿਲੀ ਆ ਅਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਸ਼ਾਮਿਲ ਹੋਣਾ ਵੀ ਚਾਹੀਦਾ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਸਿਰਫ ਮੰਦਰ ਜਾਓ ਗੁਰਦੁਆਰੇ ਜਾਓ ਜਿੱਥੇ ਵੀ ਜਾਓ ਜਿੱਥੇ ਤੁਹਾਡਾ ਦਿਲ ਕਰਦਾ ਹੈ ਜਾਓ ਜਾਣਾ ਜ਼ਰੂਰ ਚਾਹੀਦਾ ਏ ਆ ਆਪਣੇ ਪਰਮਾਤਮਾ ਦੇ ਨਾਲ ਥੋੜ੍ਹੀ ਦੇਰ ਧਿਆਨ ਜ਼ਰੂਰ ਲਗਾਉਣਾ ਚਾਹੀਦਾ ਹੈ ਉਹਦੇ ਕੰਮ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਏ ਜਿਹਦੇ ਨਾਲ ਇਹ ਜਿਹੜੀ ਮਨ ਦੀ ਜਿਹੜੀ ਸ਼ਾਂਤੀ ਬਣੀ ਰਹਿੰਦੀ ਏ ਅਤੇ ਸਾਨੂੰ ਚੰਗਾ ਵੀ ਲੱਗਦਾ ਹੈ